ਹਾਂਜੀ ਖਾਲਸਾ ਫਰਨੀਚਰ ਹਾਊਸ ਜੀ ਸਰ ਮੈਂ ਬਰਨਾਲੇ ਤੋਂ ਬੋਲਦਾਂ ਜੀ ਜਗਦੇਵ ਸਿੰਘ ਇਹ ਤੁਹਾਡਾ ਮੈਂ ਐਡ ਦੇਖੀ ਸੀ ਮੈਂ ਫੇਸਬੁੱਕ 'ਤੇ ਤੁਸੀਂ ਫਰਨੀਚਰ ਬਾਰੇ ਕੋਈ ਐਡ ਸੀ ਸਰ ਤੁਹਾਡੇ ਕੋਲ ਲੋੜੀਂਦਾ ਘਰ ਦੇ ਲੋੜੀਂਦਾ ਸਾਰੇ ਤਰ੍ਹਾਂ ਦਾ ਫਰਨੀਚਰ ਮਿਲ ਜਾਂਦਾ ਜੀ ਸਰ ਜਿਵੇਂ ਹੁਣ ਮੈਨੂੰ ਨਾ ਘਰ ਵਾਸਤੇ ਦੇਖੋ ਡਾਈਨਿੰਗ ਦੀ ਵੀ ਲੋੜ ਸੀ ਸੋਫਾ ਸੈੱਟ ਦੀ ਲੋੜ ਸੀ ਇਸ ਤੋਂ ਬਿਨ੍ਹਾਂ ਇੱਕ ਦੋ ਚੀਜ਼ਾਂ ਹੋਰ ਨੇ ਪਰ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਮੈਨੂੰ ਦੱਸੋ ਵੀ ਤੁਸੀਂ ਆਪ ਤਿਆਰ ਕਰਵਾਉਂਦੇ ਹੋ ਜਾਂ ਫਿਰ ਤੁਸੀਂ ਖਰੀਦ ਕੇ ਲਿਆਉਂਦੇ ਹੋ ਉਹਨੂੰ ਅੱਗੇ ਵੇਚਦੇ ਹੋ ਠੀਕ ਹੈ ਜੀ ਠੀਕ ਆ ਜੀ ਚੱਲੋ ਵਧੀਆ ਮੈਂ ਵੀ ਇਹ ਹੀ ਚਾਹੁੰਦਾ ਸੀ ਕਿ ਬੰਦਾ ਖੁਦ ਤਿਆਰ ਕਰੇ ਕਮ ਸੇ ਕਮ ਚੀਜ਼ ਹੈ ਜਿਹੜੀ ਕੁਆਲਿਟੀ ਵਾਲੀ ਮਿਲ ਜਾਂਦੀ ਹੈ ਬਟ ਇਹ ਆਪਣਾ ਸੋਫਾ ਸੈੱਟ ਜੀ ਗਿਆਰ੍ਹਾਂ ਸੀਟਾਂ ਦਾ ਸੋਫਾ ਸੈੱਟ ਕਿੰਨੇ ਦਾ ਤਿਆਰ ਹੋ ਜਾਵੇਗਾ ਜੀ ਆਪਣਾ ਇਹਦੀ ਕੋਈ ਗਰੰਟੀ

ਇਹ ਕਿੰਨੇ ਚਿਰ ਦੀ ਗਰਾਨ ਕਿੰਨੇ ਸਮੇਂ ਦੀ ਗਰੰਟੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਤਾਂ ਹੈ ਇੱਕ ਡਾਈਨਿੰਗ ਟੇਬਲ ਕਿਸ ਰੇਂਜ ਤੋਂ ਕਿਹੜੀ ਕੁਆਲਿਟੀ ਦੇ ਸ਼ੁਰੂ ਹੁੰਦੇ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕੁਰਸੀਆਂ ਐਂ ਤਾਂ ਜਿਹੜਾ ਜਿਹੜਾ ਬੇਸ ਹੈ ਉਹ ਕਿਹੜੀ ਲੱਕੜ ਦਾ ਤਿਆਰ ਕਰਦੇ ਹੋ ਜੀ ਠੀਕ ਹੈ ਆਪਾਂ ਹੋਰ ਚੱਲੋ ਕੋਈ ਟਾਹਲੀ ਦਾ ਪਿਆ ਹੈ ਜੀ ਠੀਕ ਹੈ ਜੀ ਚੱਲੋ ਬਾਕੀ ਬਾਕੀ ਚੱਲੋ ਮੌਕੇ 'ਤੇ ਦੇਖ ਲਾਂਗੇ ਜੀ ਅਤੇ ਜ਼ਰੂਰ ਦੁਕਾਨ ਤਾਂ ਖੁੱਲ੍ਹੀ ਹੁੰਦੀ ਹੋਊ ਜੀ ਆਪਣੀ ਆਪਾਂ ਸ਼ਾਮ ਨੂੰ ਕਿੰਨੇ ਵਜੇ ਤੱਕ

ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਓ ਓਕੇ ਜੀ ਸਤਿ ਸ਼੍ਰੀ ਅਕਾਲ